ਸਟੈਂਪਾਂ ਨੂੰ ਇਕੱਠਾ ਕਰਨ ਦਾ ਵਿੱਦਿਅਕ ਮੁੱਲ ਇਹ ਹੈ ਕਿ ਮੈਨੂੰ ਸਟੈਂਪਾਂ ਨ ਸਟੈਂਪਾਂ ਨੂੰ ਇਕੱਠਾ ਕਰਕੇ ਰੱਖਣਾ ਬਹੁਤ ਹੀ ਪਸੰਦ ਹੈ ਮੇਰੇ ਦਾਦਾ ਜੀ ਕਚਹਿਰੀ ਵਿੱਚ ਵਕੀਲ ਦੀ ਨੌਕਰੀ ਕਰਦੇ ਸਨ ਮੈਂ ਉਨ੍ਹਾਂ ਦੀਆਂ ਸਟੈਂਪਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ ਜੋ ਮੈਨੂੰ ਉਨ੍ਹਾਂ ਦੀ ਯਾਦ ਕਰਵਾਉਂਦੇ ਹਨ ਇਹਨਾਂ ਨੂੰ ਸੰਭਾਲਣਾ ਬਹੁਤ ਹੀ ਜ਼ਰੂਰੀ ਹੈ ਇਹਨਾਂ ਤੋਂ ਸਾਨੂੰ ਕਈ ਸਿੱਖਿਆ ਮਿਲਦੀ ਹੈ ਸਾਨੂੰ ਬ ਬਹੁਤ ਸਾਰੀਆਂ ਯ ਯਾਦਾਂ ਨਾਲ ਜੁੜੀਆਂ ਹੁੰਦੀਆਂ ਹਨ ਇਸ ਤਰ੍ਹਾਂ ਸਿੱਕੇ ਵੀ ਸਿੱਕੇ ਵੀ ਸਾਨੂੰ ਬਹੁਤ ਕੁਝ ਯਾਦ ਕਰਵਾਉਂਦੇ ਹਨ ਪੁਰਾਣੇ ਜ਼ਮਾਨੇ ਦੇ ਸਿੱਕਿਆਂ ਪਿੱਛੇ ਕਣਕ ਦੀ ਬਲਦਾਂ ਦੀ ਫੋਟੋ ਬਣੀ ਹੁੰਦੀ ਸੀਗੀ ਜੋ ਸਾਨੂੰ ਵਿੱਚ ਕ ਇੱਕ ਰੁਪਏ ਦੇ ਬਦਲੇ ਕਣਕ ਕਣਕ ਮਿਲਦੀ ਸੀਗੀ ਹੁਣ ਸਾਨੂੰ ਇ ਇੱਕ ਰੁਪਏ ਦੇ ਦੇ ਸਿੱਕੇ ਦੇ ਪਿੱਛੇ ਠੈਂਗਾਂ ਬਣਿਆ ਹੁੰਦਾ ਹੈ ਜਿਸ ਤੋਂ ਸਾਨੂੰ ਕੁਝ ਵੀ ਸਿੱਖਣ ਨੂੰ ਵੀ ਨਹੀਂ ਮਿਲਦਾ ਇਸ ਕਰਕੇ ਪੁਰਾਣੇ ਸਿੱਕਿਆਂ ਨੂੰ ਸੰਭਾਲਣਾ ਬਹੁਤ ਹੀ ਮਹੱਤਵਪੂਰਨ ਹੈ